ਜਿਵੇਂ ਕੀ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਘਰ ਬੈਠੇ ਹੀ ਦੂਰ ਦੂਰ ਤੱਕ ਸਾਰੇ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਸਕਦੇ ਹਾਂ ਸਭ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਲੋਕਾਂ ਨਾਲ ਮਿਲ ਜੁਲ ਸਕਦੇ ਆਂ ਤੇ ਉਹਨਾਂ ਦੇ ਨਾਲ ਆਪਣੇ ਹੁਨਰ ਨੂੰ ਅਸੀਂ ਸਾਂਝਾ ਕਰ ਸਕਦੇ ਹਾਂ ਸੋਸ਼ਲ ਮੀਡੀਆ ਪਲੇਟਫਾਰਮ ਕਈ ਤਰੀਕੇ ਦੇ ਹੁੰਦੇ ਹਨ ਜਿਵੇਂ ਕੀ ਫੇਸਬੁੱਕ ਇੰਸਟਾਗ੍ਰਾਮ ਅਤੇ ਯੂਟਿਊਬ ਯੂਟੀਊਬ ਇੱਕ ਬਹੁਤ ਹੀ ਪਾਪੂਲਰ ਤਰੀਕਾ ਹੈ ਜਿਸ ਦੇ ਨਾਲ ਅਸੀਂ ਲੋਕਾਂ ਤੱਕ ਆਪਣੀ ਹੁਨਰ ਨੂੰ ਪਹੁੰਚਾ ਸਕਦੇ ਹਾਂ ਯੂਟੀਊਬ ਦੇ ਉੱਤੇ ਇੱਕ ਚੈਨਲ ਹੈ ਪੰਚ ਮਿੰਟ ਕ੍ਰਾਫਟ ਜਿਸ ਨੂੰ ਦੇਖ ਕੇ ਅਸੀਂ ਅਲੱਗ ਅਲੱਗ ਤਰ੍ਹਾ ਦੇ ਹੁਨਰ ਨੂੰ ਸਿੱਖ ਸਕਦੇ ਹਾਂ ਇਸ ਦੇ ਰਾਹੀਂ ਵੇਸਟ ਮਟੀਰੀਅਲ ਤੋਂ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਵਧੀਆ ਚੀਜ਼ਾਂ ਨੂੰ ਬਣਾਉਣਾ ਸਿਖਾਇਆ ਜਾਂਦਾ ਹੈ ਅਸੀਂ ਘਰ ਦੇ ਵਿੱਚ ਵੀ ਇਸ ਨੂੰ ਵਰਤਦੇ ਹਾਂ ਮੈਂ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਸਿਖਾਉਂਦੀ ਹਾਂ ਅਸੀਂ ਵੇਸਟ ਮਟੀਰੀਅਲ ਤੋਂ ਕਾਫੀ ਕੁਝ ਬਣਾਇਆ ਹੈ ਜਿਵੇਂ ਕੀ ਅਸੀਂ ਪੁਰਾਣੀਆਂ ਬੋਤਲਾਂ ਤੋਂ ਪੈਨ ਹੋਲਡਰ ਬਣਾਏ ਹਨ ਜਿਸ ਦੇ ਵਿੱਚ ਅਸੀਂ ਪੈਨ ਰੱਖ ਸਕਦੇ ਹਾਂ ਇਸ ਤੋਂ ਇਲਾਵਾ ਪੁਰਾਣੀਆਂ ਬੋਤਲਾਂ ਤੋਂ ਪੌਦੇ ਲਗਾਉਣ ਲਈ ਸਟੈਂਡ ਵੀ ਬਣਾਏ ਜਾਂਦੇ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪੌਦੇ ਵੀ ਲਗਾਏ ਜਾ ਸਕਦੇ ਹਨ ਇਸ ਦੇ ਨਾਲ ਘਰ ਦੇ ਵਿੱਚ ਡੈਕੋਰੇਸ਼ਨ ਜਿਹੜੀ ਹੈ ਉਹ ਬਹੁਤ ਸੋਹਣੀ ਹੋ ਸਕਦੀ ਹੈ ਪੁਰਾਣੀਆਂ ਸੀਡੀਜ਼ ਤੋਂ ਅਸੀਂ ਘਰ ਦੇ ਵਿੱਚ ਸਜਾਵਟੀ ਸਮਾਨ ਵੀ ਬਣਾ ਸਕਦੇ ਹਾਂ ਕਈ ਤਰ੍ਹਾ ਦੇ ਫੁੱਲ ਵੀ ਬਣਾਏ ਜਾਂਦੇ ਹਨ ਫਾਲਤੂ ਕੱਪੜੇ ਅਤੇ ਪੁਰਾਣੀ ਉੱਨ ਤੋ ਕਈ ਤਰ੍ਹਾ ਦੇ ਫੁੱਲ ਮੈਂ ਆਪਣੇ ਘਰ ਦੇ ਵਿੱਚ ਵੀ ਤਿਆਰ ਕੀਤੇ ਹਨ ਇਸ ਤਰ੍ਹਾਂ ਜਿਹੜੀ ਸੋਸ਼ਲ ਮੀਡੀਆ ਹੈ ਉਹ ਸਾਨੂੰ ਆਪਣੀ ਕਲਾ ਤੇ ਹੁਨਰ ਨੂੰ ਨਿਖਾਰਨ ਵਿੱਚ ਬਹੁਤ ਮਦਦ ਕਰਦੀ ਹੈ ਇਸ ਦੇ ਨਾਲ ਅਸੀਂ ਆਪਣੇ ਹੁਨਰ ਨੂੰ ਲੋਕਾਂ ਤੱਕ ਵੀ ਪਹੁੰਚਾ ਸਕਦੇ ਹਾਂ